ਪਹਿਲਾਂ ਅਸੀਂ ਖੂਹ 'ਚੋਂ ਪਾਣੀ ਕੱਢਣ ਲਈ ਬਾਲਟੀ ਨਾਲ ਰੱਸੀ ਬੰਨ੍ਹ ਕੇ ਉਹਨੂੰ ਵਿੱਚ ਛੱਡਦੇ ਸੀ ਉਸ ਨੂੰ ਪਾਣ ਬਾਲਟੀ ਨੂੰ ਭਰ ਕੇ ਬਾਹਰ ਕੱਢਣਾ ਪਰ ਹੁਣ ਉਹ ਕੰਮ ਬੜਾ ਹੀ ਮੁਸ਼ਕਿਲ ਹੋ ਗਿਆ ਅੱਜ ਕੱਲ੍ਹ ਦੇ ਬੱਚੇ ਉਹ ਕੰਮ ਨਹੀਂ ਕਰ ਸਕਦੇ ਇਸ ਲਈ ਉਹ ਕੰਮ ਕਰਨਾ ਨਹੀਂ ਉਹ ਬਹੁਤ ਮੁਸ਼ਕਿਲ ਮੰਨਦੇ ਹਨ ਇਸ ਲਈ ਮੈਂ ਸੋਚਿਆ ਅੱਜ ਕੱਲ੍ਹ ਮੋਟਰ ਦਾ ਯੁੱਗ ਆ ਗਿਆ ਹੈ ਕਿ ਕਿਉਂ ਨਾ ਹੁਣ ਭਾਈ ਨੂੰ ਬੁਲਾ ਕੇ ਬਿਜਲੀ ਵਾਲੇ ਕੋਲੋਂ ਮੋਟਰ ਲਵਾ ਲਈ ਜਾਵੇ ਜਾਂ ਕਿ ਪਾਣੀ ਕੱਢਣਾ ਸੌਖਾ ਹੋ ਜਾਵੇਗਾ ਇਸ ਲਈ ਅੱਜ ਮੈਂ ਭਾਈ ਨੂੰ ਬੁਲਾਇਆ ਤਾਂ ਉਹਨਾਂ ਨੂੰ ਇਹ ਦਿਖਾਇਆ ਵੀ ਕਿੰਨੇ ਇਸ ਦੇ ਵਿੱਚ ਖਰਚਾ ਹੋਵੇਗਾ ਅਤੇ ਕਿੰਨਾ ਟਾਈਮ ਲੱਗੇਗਾ ਤਾਂ ਉਸਨੇ ਦੱਸਿਆ ਵੀ ਤੁਸੀਂ ਇੰਨੀ ਤਾਰ ਜਾਂ ਮੋਟਰ ਲੈ ਆਓ ਬਾਕੀ ਸਾਰਾ ਕੁਛ ਮੈਂ ਆਪ ਹੀ ਕਰ ਲਵਾਂਗਾ ਤਾਂ ਅੱਜ ਅਸੀਂ ਭਾਈ ਕੋਲੋਂ ਮੋਟਰ ਲਵਾਈ ਜਿਹਦੇ ਨਾਲ ਅਸੀਂ ਖੂਹ 'ਚੋਂ ਪਾਣੀ ਕੱਢਣਾ ਸਾਨੂੰ ਬਹੁਤ ਸੌਖਾ ਹੋ ਗਿਆ ਜਿਸ ਨੂੰ ਦੇਖ ਕੇ ਸਾਡੇ ਬੱਚੇ ਬਹੁਤ ਖੁਸ਼ ਹੋਏ ਵੀ ਇਹ ਤਾਂ ਕੰਮ ਬਹੁਤ ਸੌਖਾ ਹੋ ਗਿਆ